ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਉਪਕਰਨ ਆ ਗਏ ਹਨ ਜਿਹੜਾ ਕਿ ਸਾਡੀਆਂ ਭਵਿੱਖ ਵਿੱਚ ਹੋਣ ਵਾਲੀਆਂ ਬਹੁਤ ਚੀਜ਼ਾਂ ਦੇ ਵਿੱਚ ਸਾਨੂੰ ਇਸ ਸਹੂਲਤ ਪ੍ਰਦਾਨ ਕਰਦਾ ਹੈ ਜਿਵੇਂ ਕਿ ਅੱਜ ਦੇ ਟੈਮ ਦੇ ਵਿੱਚ ਇੰਟਰਨੈੱਟ ਮੋਬਾਇਲ ਫੋਨ ਕੰਪਿਊਟਰ ਦੇ ਵਿੱਚ ਹਰ ਇੱਕ ਚੀਜ਼ ਤਕਨੀਕ ਨੂੰ ਅਸੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਔਰ ਜਿਹੜੀਆਂ ਵੀ ਸਾਨੂੰ ਜ਼ਰੂਰਤਾਂ ਹੁੰਦੀਆਂ ਹੈ ਅਸੀਂ ਉਸਨੂੰ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਰਿਸੀਵ ਕਰ ਲੈਂਦੇ ਹਨ ਬਟ ਆਉਣ ਵਾਲੇ ਟਾਈਮ ਦੇ ਵਿੱਚ ਏ ਆਈ ਆਰਟੀਫਿਸ਼ਅਲ ਇੰਟੈਲੀਜੈਂਸੀ ਦੁਆਰਾ ਜੋ ਕੰਮ ਕੀਤਾ ਜਾਊਗਾ ਉਹ ਇਹੀ ਹੋਊਗਾ ਕਿ ਇਨ ਫਿਊਚਰ ਦੇ ਵਿੱਚ ਇਹ ਏ ਆਈ ਕੰਪਨੀ ਆਪਣੇ ਇੰਮਪੋਲਾਏ ਨੂੰ ਔਡਰ ਦਊਗੀ ਔਰ ਉਹੀ ਇੰਸਟਰਕਸ਼ਨ ਵਗੈਰਾ ਦੇਊਗੀ ਕਿ ਤੁਸੀਂ ਕਿਹੜੇ ਕੰਮ ਨੂੰ ਕਿਸ ਤਰ੍ਹਾਂ ਕਰਨਾ ਹੈ ਕਿਉਂਕਿ ਗਾਹਾਂ ਤੋਂ ਗਾਹਾਂ ਆਹ ਸਾਇੰਟਿਸਟ ਨੇ ਇਕ ਨਵੀਂ ਤੋਂ ਨਵੀਂ ਖੋਜ ਕਰਨੀ ਆ ਔਰ ਉਹਦੇ ਅਕੋਡਿੰਗ ਉਹ ਕਿਸ ਤਰ੍ਹਾਂ ਦਾ ਉਪਕਰਨ ਔਰ ਕਿਸ ਤਰ੍ਹਾਂ ਦੀ ਕਰਦਾ ਹੈ ਤਾਂ ਇਹ ਸਭ ਤੋਂ ਇਹ ਇਹ ਸਾਡੇ ਭਵਿੱਖ ਵਿੱਚ ਵਿਕਾਸ ਦਾ ਸਭ ਤੋਂ ਵਿਕਾਸ ਦਾ ਸਫਲਤਾ ਦਾ ਸਭ ਤੋਂ ਵੱਧ ਸਾ ਸਾਧਨ ਬਣੂੰਗਾ